ਪੰਜਾਬੀ ਭਾਸ਼ਾ ਪੰਜਾਬੀ ਭਾਸ਼ਾ ਪੰਜਾਬ ਦੀ ਮਾਂ ਬੋਲੀ ਦੇ ਨਾਂ ਤੋਂ ਹੀ ਜਾਣਿਆ ਜਾਂਦਾ ਹੈ ਜਿਸ ਵਿੱਚ ਪੰਜਾਬ ਨੂੰ ਬੜੇ ਹੀ ਸਤਿਕਾਰ ਨਾਲ ਇਹਨੂੰ ਬੋਲਿਆ ਅਤੇ ਇਹਨੂੰ ਮਾਣ ਦਿੱਤਾ ਜਾਂਦਾ ਹੈ ਪਰ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਦਾ ਵਿਦੇਸ਼ੀ ਰੁਝਾਨ ਹੋਣ ਕਾਰਨ ਉਹ ਆਪਣੀ ਮਾਂ ਬੋਲੀ ਨੂੰ ਭੁੱਲਦੇ ਜਾ ਰਹੇ ਹਨ ਅਤੇ ਪੰਜਾਬ ਦੇ ਹੀ ਵਿੱਚੋਂ ਹੀ ਹੌਲੀ ਹੌਲੀ ਅਲੋਪ ਹੋਣ ਦੇ ਖਤਰੇ ਦੇ ਵਿੱਚ ਆ ਰਹੀ ਹੈ ਕਿਉਂਕਿ ਅੱਜ ਦੇ ਨੌਜਵਾਨ ਵਿਦੇਸ਼ਾਂ ਵਿੱਚ ਆਪਣਾ ਵਧੀਆ ਭਵਿੱਖ ਅਤੇ ਮੌਕੇ ਦੇਖਣ ਕਾਰਨ ਵਿਦੇਸ਼ੀ ਭਾਸ਼ਾ ਨੂੰ ਸਿੱਖਣ ਲਈ ਵੱਧ ਤੋਂ ਵੱਧ ਜਿਹੜਾ ਹੈ ਆਪਣਾ ਜੋਰ ਲਾ ਰਹੇ ਹਨ ਜਿਸ ਨਾਲ ਉਹ ਆਪਣੀ ਭਾਸ਼ਾ ਨੂੰ ਭੁੱਲਦੇ ਜਾ ਰਹੇ ਹਨ ਭਾਸ਼ਾ ਦੇ ਨਾਲ ਹੀ ਆਪਣਾ ਸੱਭਿਆਚਾਰ ਜਿਹੜਾ ਕੀ ਪਛਾਣ ਹੁੰਦਾ ਹੈ ਭਾਸ਼ਾ ਹੀ ਸਾਡੀ ਅਪ ਸ ਆਪਣੇ ਸ ਸਾਡੇ ਸੱਭਿਆਚਾਰ ਨੂੰ ਬਚਾਉਂਦੀ ਹੈ ਜਿਸ ਕਾਰਨ ਇਹ ਨੌਜਵਾਨਾਂ ਨੂੰ ਰੁਝਾਨ ਕਾਰਨ ਵ ਵਿਦੇਸ਼ੀ ਰੁਝਾਨ ਹੋਣ ਕਾਰਨ ਉਹ ਆਪਣੇ ਪੰਜਾਬੀ ਭਾਸ਼ਾ ਮਾਤ ਭਾਸ਼ਾ ਤੋਂ ਇਲਾਵਾ ਆਪਣੇ ਸੱਭਿਆਚਾਰ ਤੋਂ ਵੀ ਦੂਰ ਹੋ ਰਹੇ ਹਨ ਕੋਈ ਵੀ ਭਾਸ਼ਾ ਕਿਸੇ ਵੀ ਖੇਤਰ ਦੀ ਬੋਲੀ ਜਾਂਦੀ ਹੈ ਉਹ ਆਪਣੇ ਸੱਭਿਆਚਾਰ ਨਾਲ ਹੀ ਹੀ ਜੁੜੀ ਹੁੰਦੀ ਹੈ ਅਤੇ ਅਗਰ ਕੋਈ ਵਿਅਕਤੀ ਆਪਣੀ ਮਾਤ ਭਾਸ਼ਾ ਸਬ ਖੇਤਰੀ ਭਾਸ਼ਾ ਬੋਲਦਾ ਹੈ ਤਾਂ ਇਸਦਾ ਮਤਲਬ ਉਹ ਹੁੰਦਾ ਹੈ ਕਿ ਉਹ ਆਪਣੇ ਹੀ ਸੱਭਿਆਚਾਰ ਨਾਲ ਜੁੜਿਆ ਹੈ ਪਰ ਅੱਜ ਦੇ ਮੋਡਰਨ ਜ਼ਮਾਨੇ 'ਚ ਆਧੁਨਿਕ ਸਮੇਂ ਵਿੱਚ ਜਿਹੜੀ ਹੈ ਇੰਗਲਿਸ਼ ਭਾਸ਼ਾ ਨੂੰ ਹੀ ਬਹੁਤ ਜ਼ਿਆਦਾ ਮਹੱਤਵਪੂਰਨ ਸਥਾਨ ਦਿੱਤਾ ਜਾਂਦਾ ਹੈ ਅਤੇ ਕੋਈ ਅਗਰ ਆਪਣੀ ਖੇਤਰੀ ਜਾਂ ਪੰਜਾਬੀ ਭਾਸ਼ਾ ਬੋਲ ਰਿਹਾ ਤਾਂ ਉਸਨੂੰ ਇੱਕ ਪਿਛੋਕੜ ਇਲਾਕੇ 'ਚੋਂ ਜਾਂ ਫਿਰ ਅਨਪੜ੍ਹ ਵਿਅਕਤੀਆਂ ਦੇ ਵਿੱਚ ਉਸ ਦੀ ਗਣਨਾ ਕੀਤੀ ਜਾਂਦੀ ਹੈ ਪੰਜਾਬ ਹੋਰ ਹੋਰ ਭਾਸ਼ਾਵਾਂ ਲਈ ਕੋਈ ਨਹੀਂ ਇਸਨੂੰ ਇਸ ਵਿਅਕਤੀ ਨੂੰ ਸਾਰੀਆਂ ਭਾਸ਼ਾਵਾਂ ਜਿਹੜੀਆਂ ਹੈ ਜ਼ਰੂਰਤ ਪੈਣ 'ਤੇ ਆ ਸਕਣ ਉਹ ਸਾਰੀਆਂ ਸਿੱਖਣੀਆਂ ਚਾਹੀਦੀਆਂ ਪਰ ਆਪਣੀ ਮਾਤ ਭਾਸ਼ਾ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਇਹ ਭਾਸ਼ਾ ਆਪਣੇ ਸੱਭਿਆਚਾਰ ਨਾਲ ਜੁੜੀ ਹੁੰਦੀ ਹੈ ਅਤੇ ਆਪਣੇ ਸੱਭਿਆਚਾਰ ਨਾਲ ਪਛਾਣ ਦੱਸਦੀ ਹੈ ਇਸ ਕਰਕੇ ਪੰਜਾਬੀ ਭਾਸ਼ਾ ਜਿਹੜੀ ਹੈ ਬੋਲਣ ਵਿੱਚ ਨਾ ਹੀ ਸਾਨੂੰ ਸ਼ਰਮ ਕਰਨੀ ਚਾਹੀਦੀ ਹੈ ਅਤੇ ਇਹਦੇ ਵਿੱਚ ਕੋਈ ਵਿਅਕਤੀ ਅਗਰ ਬੋਲ ਰਿਹਾ ਸਗੋਂ ਉਸ ਨੂੰ ਉਸ ਨਾਲ ਵੀ ਸਗੋਂ ਆਪਣੀ ਹੀ ਖੇਤਰੀ ਭਾਸ਼ਾ ਨਾਲ ਜਿਹੜੀ ਹੈ ਗੱਲ ਕਰਨੀ ਚਾਹੀਦੀ ਜਿਸ ਨਾਲ ਉਸਨੂੰ ਆਪਣੀ ਭਾਸ਼ਾ ਬੋਲਣ ਵਿੱਚ ਕੋਈ ਵੀ ਸ਼ਰਮਿੰਦਗੀ ਮਹਿਸੂਸ ਨਾ ਕਰੇ ਅਤੇ ਅੰਤ ਵਿੱਚ ਮੈਂ ਇਹ ਹੀ ਕਹਿਣਾ ਚਾਹੁੰਦਾ ਹਾਂ ਕੀ ਆਪਣੀ ਹੀ ਖੇਤਰ ਭਾਸ਼ਾ ਜਾਂ ਮਾਤ ਭਾਸ਼ਾ ਨੂੰ ਕਦੀ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਅਗਰ ਤੁਸੀਂ ਆਪਣੀ ਮਾਤ ਭਾਸ਼ਾ ਨੂੰ ਹੀ ਭੁੱਲਦੇ ਜਾ ਰਹੇ ਹੋ ਤਾਂ ਆਪਣੇ ਤੁਸੀਂ ਆਪਣੇ ਇੱਕ ਸੱਭਿਆਚਾਰਕ ਆਪਣੇ ਰੀਤੀ ਰਿਵਾਜ਼ ਆਪਣੇ ਦੇਸ਼ ਤੋਂ ਆਪਣੇ ਖੇਤਰ ਤੋਂ ਇੱਕ ਤੁਸੀਂ ਦੂਰ ਹੁੰਦੇ ਜਾ ਰਹੇ ਹੋ ਕਿ ਇੱਕ ਆਪਣੀ ਮਾਤ ਭਾਸ਼ਾ ਇੱਕ ਮਾਂ ਬੋ ਮਾਂ ਬੋਲੀ ਦਾ ਦਰਜਾ ਦਿੰਦੀ ਹੈ ਅਤੇ ਤੁਸੀਂ ਇਸ ਭਾਸ਼ਾ ਤੋਂ ਦੂਰ ਹੋ ਰਹੇ ਹੋ ਇਸ ਦਾ ਮਤਲਬ ਤੁਸੀਂ ਆਪਣੀ ਮਾਂ ਤੋਂ ਦੂਰ ਹੋ ਰਹੇ ਹੋ ਇਸ ਲਈ ਆਪਣੀ ਭਾਸ਼ਾ ਨੂੰ ਬੋਲਣ ਦੇ ਵਿੱਚ ਸਾਨੂੰ ਕੋਈ ਸ਼ਰਮ ਨਹੀਂ ਕਰਨੀ ਚਾਹੀਦੀ ਹਾਂ ਸਾਨੂੰ ਹੋਰ ਸਾਰੀਆਂ ਭਾਸ਼ਾਵਾਂ ਵੀ ਸਿੱਖਣਾ ਚਾਹੀਦਾ ਕਿ ਅੱਜ ਦੇ ਟੈਮ ਵਿੱਚ ਜਿਹੜੇ ਕਅ ਤ ਕੋਂਪੀਟੀਸ਼ਨ ਹੋਣ ਦੇ ਕਾਰਨ ਬਹੁਤ ਸਾਰੇ ਜਿਹੜੇ ਹੋ ਹੋਰ ਭਾਸ਼ਾਵਾਂ ਜਿਹੜੀਆਂ ਪੈਦਾਵਾਂ ਹੋ ਰਹੀਆਂ ਹਨ ਅਤੇ ਨਵੀਆਂ ਨਵੀਆਂ ਟੈਕਨੋਲਜੀ ਆ ਰਹੀ ਹੈ ਇਸ ਲਈ ਸਾਨੂੰ ਸਾਰੀਆਂ ਭਾਸ਼ਾਵਾਂ ਦਾ ਹੁਣ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਪਰ ਇਸ ਨਾਲ ਤੁਸੀਂ ਆਪਣੀ ਹੀ ਭਾਸ਼ਾ ਨੂੰ ਭੁੱਲਦੇ ਜਾ ਰਹੇ ਹੋ ਤੁਸੀਂ ਭਾਸ਼ਾ ਨੂੰ ਇੱਕ ਆਪਣੀ ਇੱਜ਼ਤ ਨਹੀਂ ਦੇ ਰਹੇ ਹੋ ਤੋ ਬਹੁਤ ਹੀ ਹ ਹਾਨੀਕਾਰਕ ਹੈ ਇਸ ਲੀਏ ਸਾਨੂੰ ਆਪਣੀ ਭਾਸ਼ਾਓ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ